ਸਤਿ ਸ਼੍ਰੀ ਅਕਾਲ ਜੀ ਮੈਨੇ ਤੁਹਾਡੀ ਜਿਹੜੀ ਉਬਰ ਬੁੱਕ ਕਰਵਾਈ ਸੀ ਜਿਸ ਮੇਰੇ ਬੇਟੇ ਦਾ ਇਗਜ਼ਾਮ ਸੀਗਾ ਮੈਨੇ ਚੰਡੀਗੜ੍ਹ ਤੋਂ ਜ਼ੀਰਕਪੁਰ ਲਈ ਜਿਹੜੀ ਹੈਗੀ ਇਹ ਉਬਰ ਬੁੱਕ ਕਰਵਾਈ ਸੀ ਜਿਨ੍ਹਾਂ ਦੇ ਡਰਾਈਵਰ ਦੇ ਬਹੁਤ ਸਾ ਮਤਲਬ ਚੰਗੀ ਉਹਨਾਂ ਦਾ ਵਤੀਰਾ ਸੀਗਾ ਜਿਹਦੇ ਕਰਕੇ ਜਿਹੜਾ ਹੈਗਾ ਮੈਨੇ ਇਹ ਸਫ਼ਰ ਬੜਾ ਚੰਗਾ ਜਿਹੜਾ ਬਤੀਤ ਕੀਤਾ ਜਿਸ ਤਰ੍ਹਾਂ ਕਿ ਮੇਰੇ ਰਸਤੇ ਵਿੱਚ ਜਾਂਦੇ ਹੋਏ ਬਹੁਤ ਮੈਨੂੰ ਟ੍ਰੈਫਿਕ ਮਿਲੀ ਪਰ ਜਿਹੜੇ ਇਹ ਡਰਾਈਵਰ ਜਿਹੜੇ ਤੁਹਾਡੇ ਉਬਰ ਦੇ ਡਰਾਈਵਰ ਸੀਗੇ ਬੜੇ ਹੀ ਚੰਗਾ ਇਹਨਾਂ ਦਾ ਵਿਵਹਾਰ ਸੀਗਾ ਇਹਨਾਂ ਨੇ ਬੜੇ ਪੀਸਫੂਲੀ ਡਰਾਈਵਿੰਗ ਵੀ ਇਹਨਾਂ ਦੀ ਬੜੀ ਚੰਗੀ ਸੀ ਇਹਨਾਂ ਨੇ ਮੈਨੂੰ ਮੇਰੇ ਸਟੇਸ਼ਨ 'ਤੇ ਚੰਗੀ ਤਰ੍ਹਾਂ ਪਹੁੰਚਾਇਆ ਔਰ ਜਿੱਥੋਂ ਤੱਕ ਇਹਨਾਂ ਦਾ ਮੈਨੂੰ ਜਿਹੜਾ ਡਿਸਕਾਊਂਟ ਦੇਣ ਦਾ ਸੰਬੰਧ ਸੀਗਾ ਡਿਸਕਾਊਂਟ ਵੀ ਦਿੱਤਾ ਗਿਆ ਇਹ ਜਿਹੜੀ ਸਫ਼ਰ ਮੈਨੂੰ ਬੜਾ ਚੰਗਾ ਰਿਹਾ ਅਤੇ ਜਿਹਦੇ ਨਾਲ ਕੀ ਹੈ ਮੈਂ ਅੱਗੇ ਨੂੰ ਵੀ ਆਪਣੇ ਜਿੰਨੇ ਵੀ ਮੇਰੇ ਨੋਨ ਵਿੱਚ ਹੈਗੇ ਆ ਮੇਰੇ ਹੈਗੇ ਆ ਜਾਨਕਾਰ ਹੈਗੇ ਆ ਮੈਂ ਉਹਨਾਂ ਨੂੰ ਇਸ ਜਾਨਕਾਰੀ ਦਊਂਗੀ ਕਿ ਉਬਰ ਬੁੱਕ ਕਰੋ ਜਿਹਦੇ ਨਾਲ਼ ਤੁਸੀਂ ਸਫ਼ਰ ਜਿਹੜਾ ਹੈਗਾ ਆਪਨਾ ਚੰਗਾ ਬਣਾਓ ਧੰਨਵਾਦ ਜੀ